ਪਾਣੀ ਦੀ ਲੋੜ ਤਾਂ ਸਭ ਨੂੰ ਹੁੰਦੀ ਆ ਭਾਵੇਂ ਉਹ ਦਿਨ ਹੋਵੇ ਅਤੇ ਭਾਵੇਂ ਉਹ ਰਾਤ ਹੋਵੇ ਪਰ ਪਾਣੀ ਜਿਹੜਾ ਹੈਗਾ ਵਾ ਆਪਣੇ ਸਰੀਰ ਵਾਸਤੇ ਕਿ ਬਹੁਤ ਜ਼ਿਆਦਾ ਬੈਸਟ ਹੈਗਾ ਵਾ ਪਾਣੀ ਜਿਹੜਾ ਹੈਗਾ ਵਾ ਆਪਣੇ ਬੋਡੀ ਨੂੰ ਕੀ ਹੈਗਾ ਵਾ ਆਪਣਾ ਟੈਪਰੇਚਰ ਹੈਗਾ ਉਹ ਮੇਨਟੇਨ ਕਰਕੇ ਰੱਖਦਾ ਹੈਗਾ ਵਾ ਬਲੱਡ ਸਰਕੁਲੇਸ਼ਨ ਆਪਣਾ ਠੀਕ ਰੱਖਦਾ ਹੈਗਾ ਵਾ ਬਲੱਡ ਆਪਣਾ ਗਾੜਾ ਨਹੀਂ ਹੋਣ ਦਿੰਦਾ ਪਾਣੀ ਜਿਹੜਾ ਵਾ ਕਹਿੰਦੇ ਕਿ ਮੀਨਜ਼ ਦਿਨ ਦੇ ਟਾਈਮ ਆਪਾਂ ਪਾਣੀ ਜਿਹੜਾ ਵਾ ਉਹ ਜ਼ਿਆਦਾ ਕੰਨਜਿਊਮ ਕਰਨਾ ਚਾਹੀਦਾ ਵਾ ਜ਼ਿਆਦਾਤਰ ਗਰਮੀਆਂ ਦੇ ਵਿੱਚ ਕਰਨਾ ਚਾਹੀਦਾ ਹੈਗਾ ਵਾ ਕਿਉਂਕਿ ਆਪਾਂ ਨੂੰ ਡੀਹਾਈਡ੍ਰੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਆ ਪਾਣੀ ਜ਼ਰੂਰੀ ਨਹੀਂ ਕਿ ਆਪਾਂ ਪਾਣੀ ਹੀ ਜੇ ਇਕੱਲਾ ਕੋਈ ਪਾਣੀ ਨਹੀਂ ਪੀ ਸਕਦਾ ਆਪਾਂ ਉਹਦਾ ਸ਼ ਕੀ ਕਹਿੰਦੇ ਰੂਹ ਅਫਜ਼ਾ ਬਣਾ ਕੇ ਪੀ ਸਕਦੇ ਹੈਗੇ ਆ ਨਿੰਬੂ ਪਾਣੀ ਬਣਾ ਕੇ ਪੀ ਸਕਦੇ ਹੈਗੇ ਆ ਜਾਂ ਕੋਈ ਆਪਣਾ ਸ਼ੇਕ ਵਗੈਰਾ ਵੀ ਆਪਾਂ ਉਹ ਤਿਆਰ ਕਰਕੇ ਆਪਾਂ ਉਹ ਪੀ ਸਕਦੇ ਹੈਗੇ ਆ ਕਿਉਂਕਿ ਆਪਣੀ ਬੋਡੀ ਨੂੰ ਕੀ ਹੈ ਲਿਕ਼ੁਏਡ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ ਆ